ਪੰਜਾਬ ਵਿੱਚ ਹਰ ਵਰਗ ਦੇ ਲੋਕ ਇੱਥੇ ਰਹਿੰਦੇ ਹਨ ਅਤੇ ਹਰ ਬੱਚਾ ਬਾਹਰੋਂ ਇੱਥੇ ਸਿੱਖਿਆ ਪ੍ਰਾਪਤ ਕਰਨ ਲਈ ਆਉਂਦਾ ਹੈ ਕਿਉਂਕਿ ਇੱਥੇ ਸਿੱਖਿਆ ਪੜ੍ਹਾਈ ਬਹੁਤ ਵਧੀਆ ਹੈ ਇੱਥੇ ਹਰ ਭਾਸ਼ਾ ਬਾਰੇ ਗਿਆਨ ਦੇਣ ਲਈ ਕੇਂਦਰ ਖੁੱਲ੍ਹੇ ਹੋਏ ਨੇ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਉੱਥੇ ਅਲੱਗ ਅਲੱਗ ਧਰਮ ਦੇ ਲੋਕ ਆਉਂਦੇ ਹਨ ਅਤੇ ਆਪਣੇ ਰੀਤੀ ਰਿਵਾਜਾਂ ਬਾਰੇ ਇੱਕ ਦੂਜੇ ਨੂੰ ਜਾਣੂ ਕਰਾਉਂਦੇ ਹਨ ਉਹਨਾਂ ਦੀਆਂ ਭਾਸ਼ਾਵਾਂ ਬਾਰੇ ਜਾਣਦੇ ਹਨ ਇਹ ਸਭ ਕੁਝ ਸਿੱਖਿਆ ਪ੍ਰਣਾਲੀ ਉੱਤੇ ਗੂੜ੍ਹਾ ਪ੍ਰਭਾਵ ਪਾਉਂਦੀਆਂ ਹਨ